ਸਤਿ ਸ਼੍ਰੀ ਅਕਾਲ ਮੈਂ ਪ੍ਰਿਆ ਜੇਕਰ ਗੱਲ ਕੀਤੀ ਜਾਵੇ ਖੇਤਰੀ ਸਿਰਤਾਨੀ ਆਕਰਸ਼ਣ ਦੀ ਤਾਂ ਸਾਡੇ ਇੱਥੇ ਚਾਰ ਪੰਜ ਅਜਿਹੀਆਂ ਜਗ੍ਹਾ ਹਨ ਜਿਵੇਂ ਕਿ ਡਾਊਨ ਟਾਊਨ ਪਠਾਨਕੋਟ ਬਾਠ ਸਾਹਿਬ ਮਿੰਨੀ ਗੋਆ ਅਤੇ ਮੁਕੇਸ਼ਰਾ ਮੰਦਰ ਜਿੱਥੇ ਅਸੀਂ ਸੈਰ ਸਪਾਟੇ ਲਈ ਜਾ ਸਕਦੇ ਹਾਂ ਅਤੇ ਮੈਂ ਤਕਰੀਬਨ ਇਹਨਾਂ ਚਾਰਾਂ ਜਗ੍ਹਾ 'ਤੇ ਗਈ ਹੋਈ ਹਾਂ ਅਤੇ ਹੋਰ ਵੀ ਕਈ ਛੋਟੀਆਂ ਮੋਟੀਆਂ ਜਗ੍ਹਾਵਾਂ ਹਨ ਜੋ ਸੈਲਾਨੀ ਆਕਰਸ਼ਣ ਦਾ ਕਾਰਨ ਹਨ ਅਤੇ ਮੈਨੂੰ ਇਹ ਸਾਰੀਆਂ ਜਗ੍ਹਾ ਬਹੁਤ ਹੀ ਵਧੀਆ ਲੱਗੀਆਂ ਹਨ ਅਤੇ ਮੈਂ ਆਪਣੇ ਜਿਹੜੇ ਮੇਰੇ ਭਾਈਚਾਰੇ ਵਿੱਚ ਮੇਰੇ ਸਗੇ ਸੰਬੰਧੀ ਦੋਸਤ ਹਨ ਮੈਂ ਉਹਨਾਂ ਨੂੰ ਇੱਥੇ ਜਾਣ ਲਈ ਉਤਸਾਹਿਤ ਕਰਦੀ ਹਾਂ ਅਤੇ ਉਹਨਾਂ ਨੂੰ ਕਹਿੰਦੀ ਹਾਂ ਕਿ ਉਹ ਵੀ ਇੱਥੇ ਜਾਣ ਅਤੇ ਸਾਡੇ ਨਾਲ ਘੁੰਮ ਫਿਰ ਕੇ ਆਉਣ